ਨਿਊਜ ਮੀਡੀਆ ਦਾ ਸਾਨੂੰ ਬੜਾ ਹੀ ਫਾਇਦਾ ਹੈਗਾ ਵੇ ਮੇਰਾ ਸਟੀਚਿੰਗ ਮੀਟਿੰਗ ਦਾ ਕੰਮ ਸੀਗਾ ਤੇ ਮੈਂ ਮੀਡੀਆ ਵੀ ਆਪਣੀ ਮਸ਼ੂਰੀ ਕਰਵਾਈ ਥੋੜੀ ਬਹੁਤੀ ਉਸ ਕਰਕੇ ਮੇਰੇ ਥੋੜੇ ਗਾਹਕ ਵੱਧ ਗਏ ਮੈਨੂੰ ਬਹੁਤ ਇਨਕਮ ਹੋਈ ਫਾਇਦਾ ਹੋਇਆ ਤੇ ਕਿਸਾਨਾਂ ਲਈ ਤਾਂ ਬਹੁਤ ਕੁਝ ਬਣਿਆ ਹੋਇਆ ਬਹੁਤ ਸਲਾਵਾਂ ਦਿੰਦੀਆਂ ਨੇ ਬਹੁਤ ਸਲਾਹ ਮਿਲਦੀ ਹੈਗੀ ਹੈ ਜਿਵੇਂ ਕਿ ਕਿਸਾਨਾਂ ਨੂੰ ਘਰ ਘਰ ਜਾ ਕੇ ਕਈ ਵਾਰੀ ਮੀਡੀਆ ਵਾਲੇ ਪੁੱਛਦੇ ਹੈਗੇ ਨੇ ਤੁਹਾਡਾ ਕਿੰਨਾ ਨੁਕਸਾਨ ਹੋਇਆ ਬਾਰਿਸ਼ ਹੋਈ ਉਹਨਾਂ ਨੂੰ ਫਾਇਦਾ ਮਿਲਦਾ ਉਹਨਾਂ ਨੂੰ ਉਪਰੋ ਗ੍ਰਾਂਟ ਵੀ ਦਵਾਉਂਦੇ ਹੈਗੇ ਗੋਰਮਿੰਟ ਵੱਲੋਂ ਮੀਡੀਆ ਇਕ ਨੰਬਰ ਤੇ ਚੱਲਦਾ ਹੈਗਾ ਤਾਂ ਮੇਰੀ ਤਾਂ ਬਹੁਤ ਮੈਗਜ਼ੀਨ ਵੀ ਵੰਡ ਕੇ ਜਾਂਦੇ ਨੇ ਵੀ ਤੁਸੀਂ ਆਪਣੀ ਫਸਲ ਦੀ ਕਿਵੇਂ ਬੀਜਾਈ ਕਰਨੀ ਹੈ ਕਿਵੇਂ ਪਾਣੀ ਦੇਣਾ ਟਾਈਮ ਟਾਈਮ ਤੇ ਕਿਵੇਂ ਉਹਦੀ ਦੇਖਭਾਲ ਕਰਨੀ ਕਿਵੇਂ ਖਾਦ ਪਾਉਣੀ ਹੈ ਇਹ ਮੀਡੀਆ ਵਾਲੇ ਜਾਂਦੇ ਨੇ ਤੇ ਉੱਥੇ ਮੈਗਜ਼ੀਨ ਦੇ ਕੇ ਆਉਂਦੇ ਨੇ ਸਾਰਾ ਪ੍ਰੋਗਰਾਮ ਵਧੀਆ ਕਰਦੇ ਨੇ